ਮੈਂ ਆਪਣੇ ਆਲੇ ਦੁਆਲੇ ਬਹੁਤ ਹੀ ਲਾਇਬ੍ਰੇਰੀਆਂ ਵੇਖੀਆਂ ਹਨ ਅਤੇ ਸਭ ਤੋਂ ਵੱਡੀ ਲਾਇਬ੍ਰੇਰੀ ਮੈਂ ਆਪਣੇ ਕਾਲਜ ਵਿੱਚ ਵੇਖੀ ਜਿਸ ਵਿੱਚ ਮੈਂ ਰੋਜ਼ ਜਾਂਦੀ ਹਾਂ ਅਤੇ ਉੱਥੇ ਜਾ ਕੇ ਅਖਬਾਰ ਅਤੇ ਆਪਣੀ ਇਹ ਮਨਪਸੰਦ ਦੀ ਕਿਤਾਬ ਪੜ੍ਹਦੀ ਹਾਂ ਅਤੇ ਇਸੇ ਤਰ੍ਹਾਂ ਦੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਮੇਰੇ ਘਰ ਵਿੱਚ ਵੀ ਬਣੀ ਹੋਈ ਹੈ ਜਿਸ ਵਿੱਚ ਮੇਰੇ ਸਬਜੈਕਟ ਨਾਲ ਰਿਲੇਟਡ ਕਿਤਾਬਾਂ ਪਈਆਂ ਹਨ ਅਤੇ ਕਈ ਨੋਵਲ ਅਤੇ ਕਹਾਣੀਆਂ ਦੀਆਂ ਕਿਤਾਬਾਂ ਵੀ ਹਨ ਕਿਉਂਕਿ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਜਦੋਂ ਵੀ ਮੇਰਾ ਫ੍ਰੀ ਟਾਈਮ ਹੁੰਦਾ ਹੈ ਤਾਂ ਮੈਂ ਆਪਣੇ ਘਰ ਘਰ ਵਿੱਚ ਬਣੀ ਹੋਈ ਲਾਇਬ੍ਰੇਰੀ ਵਿੱਚ ਪੜ੍ਹ ਬੈਠ ਕੇ ਪੜ੍ਹਦੀ ਹਾਂ ਅਤੇ ਇਹ ਲਾਇਬ੍ਰੇਰੀ ਮੇਰੇ ਮੇਰੇ ਵਿਹਲੇ ਟਾਈਮ ਨੂੰ ਗੁਜ਼ਾਰਨ ਦਾ ਇੱਕ ਚੰਗਾ ਜ਼ਰੀਆ ਹੈ ਅਤੇ ਇਸ ਕਿਤਾਬਾਂ ਪੜ੍ਹਨ ਨਾਲ ਮੇਰੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਅਤੇ ਮੈਂ ਇਹ ਲਾਇਬ੍ਰੇਰੀ ਆਪਣੇ ਮੈਂ ਇਹ ਲਾਇਬ੍ਰੇਰੀ ਨੂੰ ਹੋਰ ਵਧੀਆ ਢੰਗ ਨਾਲ ਬਣਾਉਣਾ ਚਾਹੁੰਦੀ ਹਾਂ ਜਿਸ ਕਰਕੇ ਜਿਸ ਕਰਕੇ ਮੈਨੂੰ ਇਹ ਆਸ ਹੈ ਕਿ ਮੈਂ ਇੰਨ ਫਿਊਚਰ ਆਪਣੀ ਸੁਪਨਿਆਂ ਦੀ ਲਾਇਬ੍ਰੇਰੀ ਲਾਇਬ੍ਰੇਰੀ ਬਣਾਵਾਂਗੀ ਜਿਸ ਵਿੱਚ ਬਹੁਤ ਹੀ ਵਧੀਆ ਵਧੀਆ ਢੰਗ ਦੇ ਨੋਵਲ ਅਤੇ ਅਤੇ ਅਤੇ ਸੋਹਣੀਆਂ ਸੋਹਣੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਰੱਖੀਆਂ ਹੋਣਗੀਆਂ ਜੋ ਕਿ ਮੇਰੇ ਅਤੇ ਮੇਰੇ ਛੋਟੇ ਭੈਣ ਭਰਾਵਾਂ ਲਈ ਬਹੁਤ ਹੀ ਮੋਟੀਵੇਸ਼ਨਸ ਵਾਲੀਆਂ ਹੋਣਗੀਆਂ